ਪੰਜਾਬ ਵਿੱਚ ਅਭਿਆਸ ਕਿੱਤੇ ਵੱਖ ਵੱਖ ਧਰਮ ਗਰੀਬੀ ਜਾਂ ਸਮਾਜ ਭਲਾਈ ਦੇ ਮੁੱਦੇ ਨੂੰ ਸੰਬੋਧਿਤ ਕਰਦੇ ਹਨ ਸਾਰੇ ਹੀ ਧਰਮ ਮਿਲ ਜੁਲ ਕੇ ਸਮਾਜ ਭਲਾਈ ਦੇ ਕੰਮ ਕਰਦੇ ਹਨ ਜਿਵੇਂ ਕਿਸੇ ਗਰੀਬ ਦੀ ਛੱਤ ਡਿੱਗ ਪਈ ਹੈ ਅਤੇ ਉਹ ਬਣਾ ਦਿੰਦੇ ਹਨ ਗਰੀਬ ਕੁੜੀਆਂ ਦੇ ਵਿਆਹ ਰਲ ਮਿਲ ਕੇ ਕਰਦੇ ਹਨ ਗਰੀਬੀ ਅਤੇ ਵਿਧਵਾ ਭੈਣਾਂ ਨੂੰ ਹਰ ਵੇਲੇ ਰਾਸ਼ਨ ਦਿੰਦੇ ਹਨ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਸਿਲਾਈ ਸਿਖਾਉਂਦੇ ਹਨ ਕੰਪਿਊਟਰ ਸਿਖਾਉਂਦੇ ਹਨ ਲਾਈਕ ਬੱਚਿਆਂ ਦੀ ਪੜ੍ਹਾਈ ਅਤੇ ਕਿਤਾਬਾਂ ਦਾ ਖਰਚਾ ਕਰਦੇ ਹਨ ਬਿਮਾਰ ਲੋਕਾਂ ਲਈ ਫਰੀ ਜਾਂ ਘੱਟ ਰੇਟ 'ਤੇ ਇਲਾਜ ਕਰਵਾਉਣ ਲਈ ਸਹਾਇਤਾ ਕਰਦੇ ਹਨ ਜੇ ਕੋਈ ਘਰੋਂ ਪਰੇਸ਼ਾਨ ਹੋਵੇ ਤਾਂ ਉਸ ਦੀ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਉਸ ਇਨਸਾਨ ਦੀ ਮਦਦ ਕੀਤੀ ਜਾਂਦੀ ਹੈ ਫ੍ਰੀ ਕੀਰਤਨ ਸਿਖਾਇਆ ਸਿਖਲਾਈ ਦਿੱਤੀ ਜਾਂਦੀ ਹੈ ਪਾਠ ਵੀ ਫਰੀ ਸਿਖਾਇਆ ਜਾਂਦਾ ਹੈ ਇਸ ਤਰ੍ਹਾਂ ਭਲਾਈ ਦੇ ਕੰਮਾਂ ਲਈ ਸਾਰੇ ਹੀ ਧਰਮਾਂ ਵਿੱਚੋਂ ਸੁਸਾਇਟੀਆਂ ਬਣੀਆਂ ਹੁੰਦੀਆਂ ਹਨ ਸਾਰੇ ਲੋਕ ਉਹਨਾਂ ਨੂੰ ਆਪਣੀ ਦਸਵੰਧ ਦਿੰਦੇ ਹਨ ਉਹ ਦਸਵੰਧ ਜ਼ਰੂਰਤ ਮੰਦਾਂ ਲਈ ਵਰਤਿਆ ਜਾਂਦਾ ਹੈ ਗਰੀਬਾਂ ਨੂੰ ਸਰਦੀਆਂ ਵਿੱਚ ਸਵੈਟਰ ਅਤੇ ਗਰਮ ਸੂਟ ਕੰਬਲ ਵੰਡੇ ਜਾਂਦੇ ਹਨ ਅਤੇ ਗਰਮੀਆਂ ਵਿੱਚ ਪਤਲੇ ਸੂਟ ਰੈਬਰ ਦਿੱਤੇ ਜਾਂਦੇ ਹਨ ਥਾਂ ਥਾਂ 'ਤੇ ਠੰਡੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ